ਜੇ ਵੇਖਿਆ ਜਾਵੇ ਤਾਂ ਬੱਚਿਆਂ ਲਈ ਬਹੁਤ ਭਾਗ ਉਪਲਬਧ ਹਨ ਉਹਨਾਂ ਦੇ ਵਿੱਚ ਬੁਝਾਰਤਾਂ ਕਾਰਟੂਨ ਗੇਮ ਡਰਾਇੰਗ ਆਦਿ ਕਾਫੀ ਸਾਰੇ ਹਨ ਇਹਨਾਂ ਵਿੱਚ ਅਸੀਂ ਕਾਫੀ ਦੇਖ ਸਕਦੇ ਹਾਂ ਕਿ ਬੱਚਿਆਂ ਦਾ ਅੱਜ ਕੱਲ੍ਹ ਜ਼ਿਆਦਾ ਧਿਆਨ ਕਾਰਟੂਨਾਂ ਵੱਲ ਹੀ ਹੈ ਅਖਬਾਰਾਂ ਵਿੱਚ ਵੀ ਬੱਚਿਆਂ ਦੇ ਕਾਫੀ ਸਾਰੇ ਪੰਨੇ ਆਉਂਦੇ ਹਨ ਜਿਨ੍ਹਾਂ ਦੇ ਵਿੱਚ ਗੇਮ ਹੁੰਦੇ ਆ ਜਿਹਦੇ ਵਿੱਚ ਅਸੀਂ ਇੱਕ ਪੂਰਾ ਗੇਮ ਪ੍ਰੋਪਰ ਖੇਡਣਾ ਹੁੰਦਾ ਬੱਚੇ ਦੀਆਂ ਕਵਿਤਾਵਾਂ ਹੁੰਦੀਆਂ ਕਈ ਬੱਚੇ ਇੱਦਾਂ ਹੁੰਦੇ ਜੋ ਕਿ ਆਪਣੀ ਕਵਿਤਾਵਾਂ ਅਪ ਅਖਬਾਰ ਵਿੱਚ ਛਪਵਾਉਂਦੇ ਆ ਅਤੇ ਅਸੀਂ ਇਹਨਾਂ ਨੂੰ ਪੜ੍ਹ ਸਕਦੇ ਹਾਂ ਸਾਨੂੰ ਉਹ ਵਧੀਆ ਲੱਗਦੀਆਂ ਉਹਨਾਂ ਦੇ ਵਿੱਚ ਪਿੱਛੇ ਡਰਾਇੰਗ ਹੁੰਦੇ ਆ ਕਾਰਟੂਨ ਬਣੇ ਹੁੰਦੇ ਆ ਜਿਹਨਾਂ ਨਾਲ ਅਸੀਂ ਖੇਡ ਸਕਦੇ ਹਾਂ ਅਸੀਂ ਧਿਆਨ ਦੇ ਸਕਦੇ ਹਾਂ ਵੀ ਉਹ ਕਿਸ ਤਰ੍ਹਾਂ ਰੰਗ ਭਰਨਾ ਉਸਨੂੰ ਕਿਸ ਤਰ੍ਹਾਂ ਧਿਆਨ ਦੇਣਾ ਉਹਦੇ 'ਤੇ ਹੋਰ ਉਹਨਾਂ ਦੇ ਵਿੱਚ ਬੁਝਾਰਤਾਂ ਵੀ ਪਾਈਆਂ ਜਾਂਦੀਆਂ ਹਨ ਕਿ ਅਸੀਂ ਉਹਨਾਂ ਨੂੰ ਬੁਝਾਰਤਾਂ ਨੂੰ ਬੁੱਝੀਏ ਸਾਨੂੰ ਉਹ ਵਧੀਆ ਲੱਗਣ ਸਾਡੇ ਦਿਮਾਗ ਤੇਜ਼ ਹੋਵੇ ਇੰਨਾ ਇਹ ਚੀਜ਼ਾਂ ਉਹ ਇਹ ਜਿਹੜੇ ਹੈਗੇ ਇਹਨਾਂ ਵਾਸਤੇ ਹੁੰਦੇ ਆ ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਸਾਨੂੰ ਖਬਰਾਂ ਵੀ ਆਉਂਦੀਆਂ ਬਾਲ ਸੰਗ੍ਰਹਿ ਵੀ ਆਉਂਦੇ ਆ